ਹੈਲੋ ਸਤਿ ਸ਼੍ਰੀ ਅਕਾਲ ਕੌਣ ਬੋਲ ਰਹੇ ਹੋ ਹਾਂਜੀ ਦੱਸੋ ਠੀਕ ਹੈ ਜੀ ਮਿਲ ਜੂਗਾ ਜੀ ਤੁਸੀਂ ਕਿਸ ਤਰੀਕੇ ਦਾ ਘਰ ਦੇਖ ਤੁਸੀਂ ਇਕੱਲੇ ਵਾਸਤੇ ਦੇਖਣਾ ਹੈ ਕਿ ਪਰਿਵਾਰ ਵਾਸਤੇ ਦੇਖਣਾ ਜੀ ਠੀਕ ਹੈ ਜੀ ਤੁਸੀਂ ਵੀ ਕਿਸ ਤਰੀਕੇ ਦਾ ਆਪਣੇ ਉਰੇ ਇੱਕ ਬੀ ਐਚ ਕੇ ਦੇ ਆਪਸ਼ਨ ਵੀ ਹੈਗੇ ਹੈ ਜੀ ਟੂ ਬੀ ਐਚ ਕੇ ਦੀ ਆਪਸ਼ਨ ਵੀ ਹੈਗੇ ਹੈ ਜੀ ਹਾਂਜੀ ਸੁਵਿਧਾਵਾਂ ਦੇ ਨਾਲ ਜਿਸ ਤਰੀਕੇ ਦੀਆਂ ਸੁਵਿਧਾਵਾਂ ਹੋਣਗੀਆਂ ਜੀ ਉਸ ਤਰੀਕੇ ਦਾ ਆਪਣਾ ਕਿਰਾਇਆ ਤੁਹਾਨੂੰ ਪੈ ਜੂਗਾ ਜੀ ਚੋਂਤੀ ਦੇ ਵਿੱਚ ਆਪਣੇ ਕੋਲ ਜੀ ਤਿੰਨ ਮਕਾਨ ਹੈਗੇ ਆ ਜੀ ਕਿਰਾਏ 'ਤੇ ਅਤੇ ਦੋਨੇ ਇੱਕ ਪਹਿਲੇ ਮੰਜ਼ਿਲ 'ਤੇ ਆ ਅਤੇ ਦੂਜਾ ਦੂਜੀ ਮੰਜ਼ਿਲ 'ਤੇ ਆ ਜੀ ਅਤੇ ਪਹਿਲੀ ਮੰਜ਼ਿਲ ਵਾਲੇ ਦੇ ਵਿੱਚ ਹੈ ਜੀ ਉਹਦੇ ਵਿੱਚ ਤੁਹਾਨੂੰ ਦੋ ਕਮਰੇ ਮਿਲ ਜਾਣਗੇ ਜੀ ਜਿਹਦੇ ਵਿੱਚ ਤੁਹਾਨੂੰ ਬਿਸਤਰ ਲੱਗੇ ਹੋਏ ਮਿਲਣਗੇ ਜੀ ਅਤੇ ਬਾਕੀ ਰਸੋਈ ਦਾ ਤੁਹਾਨੂੰ ਸਮਾਨ ਹੈ ਜਿਹੜਾ ਉਹ ਸਭ ਤੁਹਾਨੂੰ ਆਪਣੇ ਆਪਣੇ ਆਪ ਤੋਂ ਅਰੇਂਜ ਕਰਨਾ ਪਵੇਗਾ ਜੀ ਅਤੇ ਬਾਕੀ ਜੀ ਏ ਸੀ ਦੀ ਸੁਵਿਧਾ ਵੀ ਮਿਲ ਮਿਲਜੂਗੀ ਜੀ ਅਤੇ ਜਿਹੜਾ ਦੂਜਾ ਮਕਾਨ ਹੈ ਜੀ ਉਹਦੇ ਵਿੱਚ ਉਹ ਇੱਕ ਆਰ ਕੇ ਜੀ ਉਹਦੇ ਵਿੱਚ ਕੀ ਹੈ ਵੀ ਇੱਕ ਕਮਰਾ ਹੈ ਜੀ ਅਤੇ ਛੋਟਾ ਜਿਹਾ ਹੌਲ ਮਿਲ ਜਾਊਗਾ ਜੀ ਅਤੇ ਵਿਚਾਲੇ ਕਿ ਇੱਕ ਰਸੋਈ ਮਿਲਜੂਗੀ ਜੀ ਅਤੇ ਰਸੋਈ ਦੇ ਵਿੱਚ ਤੁਹਾਨੂੰ ਪਾਣੀ ਦੀ ਸੁਵਿਧਾ ਵੀ ਮਿਲੂਗੀ ਸਭ ਸੁਵਿਧਾ ਮਿਲਜੂਗੀ ਅਤੇ ਇਹਦੇ ਵਿੱਚ ਗੀਜਰ ਅੱਛਾ ਜੀ ਕਿਰਾਇਆ ਇਹਦਾ ਤੁਹਾਨੂੰ ਪਾਊਗਾ ਜੀ ਮਹੀਨੇ ਦਾ ਅਠਾਰਾਂ ਹਜ਼ਾਰ ਰੁਪਿਆ ਜੀ ਹਾਂਜੀ ਅਠਾਰਾਂ ਹਜ਼ਾਰ ਰੁਪਿਆ ਹਾਂਜੀ ਅਠਾਰਾਂ ਹਜ਼ਾਰ ਰੁਪਿਆ ਜੀ ਤੁਹਾਡਾ ਇਹਦਾ ਕਿਰਾਇਆ ਹੋਊਗਾ ਜੀ ਅਤੇ ਉਹਦੇ ਵਿੱਚ ਤੁਹਾਨੂੰ ਸਾਰੀ ਸੁਵਿਧਾਵਾਂ ਮਿਲਣਗੀਆਂ ਬਿਜਲੀ ਦਾ ਬਿਲ ਹੈ ਜੀ ਉਹ ਅਲੱਗ ਰਹੂਗਾ ਜੀ ਪਾਣੀ ਦਾ ਅਲੱਗ ਰਹੂਗਾ ਜੀ ਹਾਂਜੀ ਅਤੇ ਸਾਡਾ ਨਹੀਂ ਨਹੀਂ ਹਾਂ ਉਹ ਆ ਜਾਇਆ ਕਰੂਗਾ ਤੁਹਾਨੂੰ ਮਹੀਨੇ ਦੀ ਮਹੀਨੇ ਅਤੇ ਉਹ ਤੁਸੀਂ ਪਰ ਦੇਖ ਲਓ ਜੀ ਅਤੇ ਹਾਂਜੀ ਨਾ ਜੀ ਗੈਸ ਦਾ ਤੁਸੀਂ ਕਿਉਂਕਿ ਉਰੇ ਆਪਣੇ ਉਹ ਸਿਸਟਮ ਹੈਗਾ ਜੀ ਸਿਲੈਡਰ ਸਿਸਟਮ ਹੀ ਹੈ ਜੀ ਤਾਂ ਸਿਲੈਡਰ ਹੈ ਜਿਹੜਾ ਉਹ ਤੁਹਾਨੂੰ ਅਗਰ ਤੁਹਾਨੂੰ ਜ਼ਰੂਰਤ ਹੈ ਤਾਂ ਅਸੀਂ ਦਬਾ ਦਾਂਗੇ ਤੁਹਾਨੂੰ ਪਰ ਅਗਰ ਤੁਸੀਂ ਖੁਦ ਤੋਂ ਕਰਨਾ ਚਾਹੁੰਦੇ ਹੋ ਭਰਵਾਉਣ ਤੋਂ ਖੁਦ ਤੋਂ ਪ੍ਰਬੰਧ ਕਰ ਸਕਦੇ ਹੋ ਜੀ ਹਾਂਜੀ ਹਾਂਜੀ ਤੁਸੀਂ ਇੱਦ ਜਿਹੜੀ ਇਹਦੇ ਇਹ ਗਲੀ ਹੈ ਜਿਸ 'ਚ ਇਹ ਘਰ ਹੈ ਜੀ ਉਹਦੇ ਨਾਲ ਵਾਲੀ ਗਲੀ ਦੇ ਵਿੱਚ ਜਿਹੜਾ ਕਿ ਇੱਕ ਚੰਡੀਗੜ੍ਹ ਦਾ ਜਿਸ ਤਰੀਕੇ ਨਾਲ ਬਣਾਇਆ ਗਿਆ ਉਹ 'ਚ ਹਰੇਕ ਸੈਕਟਰ 'ਚ ਪਾਰਕ ਹੈਗੇ ਤਾਂ ਉਹ ਇਹਦੇ ਨਾਲ ਵਾਲੀ ਗਲੀ ਦੇ ਵਿੱਚ ਹੀ ਪਾਰਕ ਹੈਗੇ ਹੈ ਜੀ ਬੱਚਿਆਂ ਦੇ ਲਈ ਸੁਬਹ ਘੁੰਮਣ ਦੇ ਲਈ ਵਧੀਆ ਉਹ 'ਤੇ ਝੂਲੇ ਸਭ ਵਧੀਆ ਤਰੀਕੇ ਦੇ ਪਾਰਕ ਬਣੇ ਹੋਏ ਹੈਗੇ ਹੈ ਜੀ ਹਾਂਜੀ ਠੀਕ ਹੈ ਜੀ